ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਰਾਣਾ ਢਾਬੇ ਤੋਂ ਬੋਲ ਦੇ ਹੋ ਜੀ ਮੈਂ ਤੁਹਾਨੂੰ ਕੁਛ ਸਮੇਂ ਪਹਿਲਾਂ ਇੱਕ ਔਡਰ ਦਿੱਤਾ ਸੀ ਉਹਦੇ ਵਿੱਚ ਪੰਜ ਦਾਲ ਮੱਖਣੀ ਸੀ ਅਤੇ ਪੰਜ ਸ਼ਾਹੀ ਪਨੀਰ ਸੀ ਅਤੇ ਤੀਹ ਰੋਟੀਆਂ ਸੀ ਅਤੇ ਉਸ ਤੋਂ ਬਾਅਦ ਕੁਝ ਖਾਲੀ ਗਲਾਸ ਔਡਰ ਕੀਤੇ ਸੀ ਅਤੇ ਉਸਦੇ ਨਾਲ ਹੀ ਪੰਜ ਠੰਡੇ ਦੀਆਂ ਬੋਤਲਾਂ ਸੀ ਉਹ ਅਚਾਨਕ ਮੇਰੇ ਦੋਸਤਾਂ ਨੇ ਕੁਛ ਨੇ ਆ ਨਹੀਂ ਸਕਦੇ ਉਹਦੇ ਕਰਕੇ ਉਹ ਔਡਰ ਮੈਂ ਘਟਾਉਣਾ ਚਾਹੁੰਦਾ ਹਾਂ ਉਹਦੇ ਵਿੱਚ ਪੰਜ ਪੰਜ ਦੀ ਬਜਾਏ ਤੁਸੀਂ ਤਿੰਨ ਤਿੰਨ ਆਈਟਮਾਂ ਭੇਜ ਦਿਓ ਸਾਰੀਆਂ ਜਿਵੇਂ ਕਿ ਪੰਜ ਬੋਤਲਾਂ ਸੀ ਤਾਂ ਤਿੰਨ ਬੋਤਲਾਂ ਕਰ ਦਿਓ ਉਸ ਤੋਂ ਬਾਅਦ ਪੰਜ ਦਾਲ ਮੱਖਣੀ ਸੀ ਅਤੇ ਤਿੰਨ ਕਰ ਦਿਓ ਅਤੇ ਜੋ ਮੈਂ ਪੈਸੇ ਸੈਂਡ ਕੀਤੇ ਸੀ ਤੁਹਾਨੂੰ ਪਹਿਲਾਂ ਬਿੱਲ ਦੇ ਬਣਦੇ ਤੁਸੀਂ ਉਹਦੇ ਵਿੱਚੋਂ ਪੰਜ ਪ੍ਰਸੈਂਟ ਡਿਸਕਾਊਂਟ ਕੀਤਾ ਸੀ ਮੈਨੂੰ ਬਣਦਾ ਉਸ ਤੋਂ ਹੁ ਹੁਣ ਉਸ ਦੇ ਹਿਸਾਬ ਨਾਲ ਤੁਸੀਂ ਇਸ ਬਿੱਲ ਦਾ ਹਿਸਾਬ ਬਣਾ ਕੇ ਮੈਨੂੰ ਮੇਰੇ ਬਚਦੇ ਪੈਸੇ ਜੋ ਮੁੰਡਾ ਔਡਰ ਦੇਣ ਆਉਂਗਾ ਉਸਦੇ ਹੱਥ ਭੇਜ ਦਿਓ ਮੈਂ ਉਸ ਤੋਂ ਪ੍ਰਾਪਤ ਕਰ ਲਊਂਗਾ ਥੈਂਕ ਯੂ ਜੀ